ਮੈਂ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪੇਂਟਿੰਗਾਂ ਸਿੱਖੀਆਂ ਹਨ ਇਤਿਹਾਸਿਕ ਵੀ ਅਤੇ ਮਨੋਰੰਜਨ ਵਾਲੀਆਂ ਵੀ ਅਤੇ ਇੱਕ ਫਰੀ ਸਟਾਈਲ ਪੇਂਟਿੰਗ ਵੀ ਸਿੱਖੀ ਹੈ ਮੇਰੀ ਮਨਪਸੰਦ ਪੇਂਟਿੰਗ ਫਰੀ ਸਟਾਈਲ ਸੀ ਜਿਸ ਵਿੱਚ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਰੰਗਾਂ ਰਾਹੀਂ ਪ੍ਰਗਟ ਕਰਕੇ ਉਸ ਨੂੰ ਇੱਕ ਖਾਲੀ ਕਾਗਜ਼ ਉੱਤੇ ਦਰਸਾ ਸਕਦੇ ਹਨ ਇਸ ਤੋਂ ਇਲਾਵਾ ਇਤਿਹਾਸਿਕ ਪੇਂਟਿੰਗ ਵੀ ਜ਼ਿੰਦਗੀ ਵਿੱਚ ਬਹੁਤ ਮਦਦਗਾਰੀ ਰਹੀ ਹੈ ਕਿਉਂਕਿ ਇਸ ਅਸੀਂ ਇਸ ਨਾਲ ਦੂਜਿਆਂ ਨੂੰ ਜਾਗਰੂਕ ਕਰ ਸਕਦੇ ਹਾਂ ਆਪਣੇ ਇਤਿਹਾਸ ਬਾਰੇ ਅਤੇ ਉਹਨਾਂ ਨੂੰ ਇਸ ਪੇਂਟਿੰਗ ਰਾਹੀਂ ਸਾਡੇ ਇਤਿਹਾਸ ਦੀ ਵੱਧ ਤੋਂ ਵੱਧ ਜਾਣਕਾਰੀ ਮਿਲ ਸਕਦੀ ਹੈ